ਪੰਜਾਬ ਵਿੱਚ ਬਹੁਤ ਘਟਨਾਵਾਂ ਹੋਈਆਂ ਸਨ ਪੰਜਾਬ ਵਿੱਚ ਸਾਡੇ ਗੁਰੂਆਂ ਨੇ ਬਹੁਤ ਯੁੱਧ ਲੜੇ ਹਨ ਪੰਜਾਬ ਵਿੱਚ ਹੋਰ ਵੀ ਯੋਧੇ ਪੈਦਾ ਹੋਏ ਜਿਹਨਾਂ ਨੇ ਪੰਜਾਬ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ ਜਿਵੇਂ ਕਿ ਸਰਦਾਰ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਸ਼ਹੀਦ ਊਧਮ ਸਿੰਘ ਜੀ ਪੰਜਾਬ ਵਿੱਚ ਇੱਕ ਮਹੱਤਵਪੂਰਨ ਘਟਨਾ ਤੇਰ੍ਹਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਵਿੱਚ ਹੀ ਹੋਈ ਇਸ ਘਟਨਾ ਵਿੱਚ ਬਹੁਤ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਣੀਆਂ ਪਈ ਗਵਾਣੀਆਂ ਪਈਆਂ ਸਨ